ਹਾਂ ਮੈਂ ਬੀਮਾ ਪੋਲਸੀ ਤੋਂ ਖੁਸ਼ ਹਾਂ ਮੈਂ ਆਪਣੇ ਪਰਿਵਾਰ ਦਾ ਸਿਹਤ ਬੀਮਾ ਕਰਵਾਇਆ ਹੋਇਆ ਹੈ ਮੈਂ ਤੁਹਾਨੂੰ ਇਸ ਦੀਆਂ ਗਤੀਵਿਧੀਆਂ ਬਾਰੇ ਦੱਸਦਾ ਹਾਂ ਇੱਕ ਬੀਮਾ ਪਾਲਸੀ ਜਾਂ ਬੀਮਾ ਪਾਲਸੀ ਦੁਰਘਟਨਾ ਬਿਮਾਰੀਆਂ ਜਾਂ ਮੌਤ ਵਰਗੀਆਂ ਅਣਕਿਆਸੀ ਘਟਨਾਵਾਂ ਤੋਂ ਸੁਰੱਖਿਆ ਦੀ ਪੇਸ਼ਕਸ ਕਰਕੇ ਵਿੱਤੀ ਸੁਰੱਖਿਆ ਅਤੇ ਮਨ ਦੀ ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਹੈ ਇਸ ਦੀ ਮਹੱਤਤਾ ਵਿੱਤੀ ਖ਼ਤਰਿਆਂ ਨੂੰ ਘਟਾਉਣ ਡਾਕਟਰੀ ਖਰਚਿਆਂ ਲਈ ਕਵਰੇਜ ਪ੍ਰਦਾਨ ਕਰਨ ਅਤੇ ਅਪਾਹਜਤਾ ਦੇ ਮਾਮਲਿਆਂ ਵਿੱਚ ਆਮਦਨੀ ਦੇ ਬਦਲ ਦੀ ਪੇਸ਼ਕਸ ਕਰਨ ਵਿੱਚ ਇਸ ਤਰ੍ਹਾਂ ਵਿੱਤੀ ਸਥਿਰਤਾ ਬਣਾਈ ਰੱਖੀ ਜਾਂਦੀ ਹੈ ਇਸ ਤੋਂ ਇਲਾਵਾ ਬੀਮਾ ਨੀਤੀਆਂ ਵਿੱਤੀ ਵਿਰਾਸਤ ਪ੍ਰਦਾਨ ਕਰਕੇ ਅਤੇ ਸੰਭਾਵੀ ਤੌਰ 'ਤੇ ਸੰਪਤੀ ਟੈਕਸਾਂ ਨੂੰ ਘਟਾ ਕੇ ਜਾਇਦਾਦ ਦੀ ਯੋਜਨਾਬੰਦੀ ਵਿੱਚ ਸਹਾਇਤਾ ਕਰ ਸਕਦੀਆਂ ਹਨ ਉਹ ਪ੍ਰੀਮੀਅਮਾਂ ਟੈਕਸ ਲਾਭ ਵੀ ਪੇਸ਼ ਕਰਦੇ ਹਨ ਅਤੇ ਦੌਲਤ ਨੂੰ ਵਧਾਉਣ ਲਈ ਇਕਾਈ ਲੀਕਐਂਡ ਬੀਮਾ ਯੋਜਨਾਵਾਂ ਵਰਗੇ ਸ਼ਾਮਿਲ ਕਰ ਸਕਦੇ ਹਨ ਬੀਮਾ ਨੀਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਵੱਖ ਵੱਖ ਕੇਂਦਰਾਂ ਏਜੰਸੀਆਂ ਅਤੇ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਬੀਮਾ ਕੰਪਨੀਆਂ ਅਤੇ ਉਹਨਾਂ ਦੀਆਂ ਸਥਾਨਕ ਸੰਖਾਵਾਂ ਪਾਲਸੀ ਜਾਰੀ ਕਰਨ ਅਤੇ ਗਾਹਕ ਸੇਵਾ ਨੂੰ ਸੰਭਾਲਦੀਆਂ ਹਨ ਜਦੋਂ ਕਿ ਏਜੰਟ ਅਤੇ ਦਲਾਲ ਵਿਅਕਤੀਗਤ ਸਲਾਹ ਪ੍ਰਦਾਨ ਕਰਦੇ ਹਨ ਅਤੇ ਨੀਤੀ ਦੀ ਚੋਣ ਦੀ ਸਹੂਲਤ ਦਿੰਦੇ ਹਨ ਇਸ ਤੋਂ ਇਲਾਵਾ ਰੈਗੂਲੈਟੀ ਸੰਸਥਾਵਾਂ ਅਤੇ ਵਿੱਤੀ ਸਲਾਹਕਾਰ ਢੁਕਵੀਆਂ ਨੀਤੀਆਂ ਦੀ ਚੋਣ ਕਰਨ ਅਤੇ ਉਦਯੋਗ ਦੇ ਮਿਆਰਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ ਇਹ ਕੇਂਦਰ ਸਮੂਹਿਕ ਤੌਰ 'ਤੇ ਬੀਮਾ ਨੀਤੀਆਂ ਦੇ ਪ੍ਰਸ਼ਾਸਨ ਪ੍ਰਬੰਧਨ ਅਨੁਕੂਲ ਦਾ ਸਮਰਥਨ ਕਰਦੇ ਹਨ ਵਿਅਕਤੀਆਂ ਲਈ ਉਹਨਾਂ ਦੀ ਪਹੁੰਚ ਯੋਗਤਾ ਅਤੇ ਪ੍ਰਭਾਵ ਨੂੰ ਵਧਾਉਂਦੇ ਹਨ